ਅੱਜ ਕੱਲ੍ਹ ਦੇ ਸਮੇਂ ਵਿੱਚ ਜਿਵੇਂ ਕਿ ਸਿੱਖਿਆ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਆਇਆ ਹੈ ਬਟ ਜੇ ਆਪਾਂ ਇਹ ਚੀਜ਼ ਇੱਕ ਹਾਈ ਲੈਵਲ 'ਤੇ ਜਾ ਕੇ ਦੇਖੀਏ ਕਿ ਆਪਾਂ ਸਟੈਮ ਯੂਨੀਵਰਸਿਟੀਆਂ ਜਾਂ ਕੋਲਜਾਂ ਦੀ ਗੱਲ ਕਰੀਏ ਉੱਥੇ ਹਜੇ ਵੀ ਪਿੰਡਾਂ ਦੇ ਲੋਕਾਂ ਦੇ ਲਈ ਜਿਹੜੇ ਬਰਾਬਰ ਦੇ ਮੌਕੇ ਨਹੀਂ ਹਨ ਕਿਉਂਕਿ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਬ ਜ਼ਿਆਦਾ ਆਉਣ ਵਾਲੀ ਪ੍ਰੋਬਲਮ ਹੁੰਦੀ ਹੈ ਉਹ ਹੈ ਕਿ ਲੈਂਗੁਏਜ ਦੀ ਪ੍ਰੋਬਲਮ ਹੈ ਜਦੋਂ ਇੱਕ ਬੱਚਾ ਇੱਕ ਲੈਂਗੁਏਜ ਪ੍ਰੋਪਰ ਨਹੀਂ ਬੋਲ ਪਾਉਂਦਾ ਤਾਂ ਉਹਨੂੰ ਕਾਫੀ ਸਾਰੇ ਇੱਦਾਂ ਦੇ ਮੌਕੇ ਨੇ ਕਾਫੀ ਸਾਰੇ ਇੱਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਜਾਂ ਇੱਦਾਂ ਦੇ ਐਕਸਟੈਂਪੋਜ ਹੁੰਦੇ ਨੇ ਜਿਹਦੇ ਵਿੱਚ ਉਹ ਬੱਚੇ ਨੂੰ ਪਾਰਟੀਸਪੇਟ ਕਰਨ ਦੇ ਲਈ ਨਹੀਂ ਅਲਾਓ ਕੀਤਾ ਜਾਂਦਾ ਕਿਉਂਕਿ ਸਕਰੀਨਿੰਗ ਦੇ ਟਾਈਮ ਦੇ ਵਿੱਚ ਹੀ ਜਦੋਂ ਬੱਚਾ ਪ੍ਰੋਪਰ ਤਰੀਕੇ ਨਾਲ ਪਰਫੋਰਮ ਨਹੀਂ ਕਰ ਪਾ ਰਿਹਾ ਹੈਗਾ ਤਾਂ ਬੱਚੇ ਨੂੰ ਉੱਥੇ ਹੀ ਸਟੋਪ ਕਰ ਦਿੱਤਾ ਜਾਂਦਾ ਸੋ ਮੇਰੇ ਅਕੋਡਿੰਗ ਜਿਹੜੇ ਪਿੰਡਾਂ ਦੇ ਲੋਕਾਂ ਦੇ ਲਈ ਹਜੇ ਵੀ ਬਰਾਬਰ ਮੌਕੇ ਨਹੀਂ ਹਨ ਜਿੰਨੇ ਕਿ ਅੱਜ ਦੇ ਟਾਈਮ ਦੇ ਵਿੱਚ ਸ਼ਹਿਰੀ ਬੱਚਿਆਂ ਨੂੰ ਮਿਲ ਰਹੇ ਹਨ